ਇੱਕ ਸਤੰਬਰ ਉੱਨੀ ਸੌ ਚੁਰਾਸੀ ਦੋ ਜੂਨ ਦੋ ਹਜ਼ਾਰ ਅੱਠ ਇੱਕ ਮਾਰਚ ਦੋ ਹਜ਼ਾਰ ਪੰਜ ਪੰਜ ਮਈ ਦੋ ਹਜ਼ਾਰ ਸੱਤ ਸਤਾਰ੍ਹਾਂ ਅਗਸਤ ਦੋ ਹਜ਼ਾਰ ਇੱਕ